ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਦੱਸੋ ਹਾਂਜੀ ਉਰੇ ਤਾਂ ਬਹੁਤ ਸਾਰੇ ਸਕੂਲ ਜਿਵੇਂ ਡੀ ਏ ਵੀ ਪਬਲਿਕ ਸਕੂਲ ਹੈ ਖਾਲਸਾ ਮੋਡਲ ਬਹੁਤ ਸਾਰੇ ਸਕੂਲ ਹੈ ਬਾਕੀ ਤੁਸੀਂ ਦੱਸੋ ਨਾ ਤੁਸੀਂ ਕਿਹੜੇ ਸਾਰੇ ਸਕੂਲ ਤਾਂ ਵਧੀਆ ਨੇ ਬਾਕੀ ਤੁਹਾਡੀ ਮਰਜ਼ੀ ਕਿਹੜੇ ਸਕੂਲ ਲਗਾਉਣਾ ਹੈ ਨਾ ਮੇਰੇ ਕੋਲ ਮੇਰੇ ਬੱਚੇ ਤਾਂ ਡੀ ਏ ਵੀ ਸਕੂਲ ਵਿੱਚ ਪੜ੍ਹਦੇ ਆ ਜੀ ਨਾਲੇ ਡੀ ਏ ਵੀ ਸਕੂਲ 'ਚ ਸਾਰੀਆਂ ਸਹੂਲਤਾਵਾਂ ਹੁੰਦੀਆਂ ਜਿਵੇਂ ਕਿ ਕਿਤਾਬਾਂ ਡਰੈੱਸ ਸਭ ਸਾਰਾ ਮਤਲਬ ਆਈ ਕਾਰਡ ਵਗੈਰਾ ਉਹਨਾਂ ਵੱਲੋਂ ਦਿੱਤਾ ਜਾਂਦਾ ਹੈ ਨਾ ਅਤੇ ਥੋੜ੍ਹੀ ਫੀਸ ਵਗੈਰਾ ਕਾਸਟ ਹੋਵੇ ਤਾਂ ਮਾਫ ਹੋ ਜਾਂਦੀ ਹੈ ਹਾਂਜੀ ਤੁਸੀਂ ਟੈਸ਼ਨ ਨਾ ਲਉ ਐਨੀਆਂ ਤਾਂ ਬੱਸਾਂ ਲੱਗੀਆਂ ਵੀਆਂ ਸਕੂਲ ਵੱਲੋਂ ਹਾਂਜੀ ਜੀ ਮੰਥਲੀ ਦੇਣੇ ਪੈਂਦੇ ਦੇਖੋ ਜਿੱਦਾਂ ਸੌ ਰੁਪਇਆ ਫੀਸ ਹੈ ਨਾ ਮਹੀਨੇ ਦੀ ਸਾਨੂੰ ਪੇ ਕਰਨੀ ਪੈਂਦੀ ਕਿੱਦਾਂ ਕਹਿੰਦੇ ਹਾਂਜੀ ਉਹ ਤਦ ਲੱਗਣਗੇ ਜਦੋਂ ਸਾਡਾ ਬੱਚਾ ਹੌਲੀ ਹੌਲੀ ਬੜੀ ਬੜੀ ਕਲਾਸ 'ਚ ਜਾਊਗਾ ਨਾ ਫ਼ਿਰ ਲੱਗਣਗੀਆਂ ਦੇਖੋ ਸਕੂਲ ਤਾਂ ਸਾਰੇ ਵਧੀਆ ਹੈ ਪਰ ਜਿਹੜੇ ਮੇਰੇ ਬੱਚੇ ਲੱਗੇ ਉਹ ਡੀ ਏ ਵੀ ਸਕੂਲ 'ਚ ਲੱਗੇ ਆ ਵੀ ਉਹ ਬੈਟਰ ਲੱਗਦਾ ਮੈਨੂੰ ਉਹ ਸਕੂਲ ਅੱਗੇ ਤੁਹਾਡੀ ਮਰਜ਼ੀ ਤੁਸੀਂ ਕਿੱਥੇ ਲਗਾਉਣਾ ਵਾ ਬੱਚਿਆਂ ਨੂੰ ਹੈ ਨਾ ਹਾਂਜੀ ਠੀਕ ਹੈ ਚੱਲੂਗੀ ਜੀ ਪੱਕਾ ਸਤਿ ਸ਼੍ਰੀ ਅਕਾਲ